ਹਾਂਜੀ ਸੈਰ ਸਪਾਟਾ ਕਰਨ ਨੂੰ ਥਾਂ ਤਾਂ ਬਹੁਤ ਹਨ ਅਤੇ ਅਸੀਂ ਆਪਣੇ ਮਹਿਮਾਨਾਂ ਨੂੰ ਉੱਥੇ ਲੈ ਕੇ ਜਾਣਾ ਵੀ ਚਾਹੁੰਦੇ ਹਾਂ ਜਿਵੇਂ ਅਸੀਂ ਉਹਨਾਂ ਨੂੰ ਜੇ ਆਪਾਂ ਅੰਮ੍ਰਿਤਸਰ ਜਾਈਏ ਤਾਂ ਅਸੀਂ ਉਹਨਾਂ ਨੂੰ ਕੰਪਨੀ ਬਾਗ ਲੈ ਕੇ ਜਾਵਾਂਗੇ ਜਾਂ ਕਿਤੇ ਗੁਰਦੁਆਰੇ ਲੈ ਜਾਵਾਂਗੇ ਉੱਥੋਂ ਘੁੰਮਾ ਫਿਰਾ ਲਿਆਵਾਂਗੇ ਜਾਂ ਆਪਾਂ ਵਾਹਗਾ ਬਾਰਡਰ ਲੈ ਜਾਵਾਂਗੇ ਉਹਨਾਂ ਨੂੰ ਘੁੰਮਾਉਣ ਫਿਰਾਉਣ ਵਾਸਤੇ ਅਤੇ ਉੱਥੋਂ ਵਾਹਗਾ ਬਾਰਡਰ ਹੋ ਕੇ ਫਿਰ ਆਪਾਂ ਜੇ ਆਪਾਂ ਚੰਡੀਗੜ੍ਹ ਵਾਲੀ ਸਾਈਡ 'ਤੇ ਜਾਂਦੇ ਹਾਂ ਤਾਂ ਉੱਧਰ ਸਾਨੂੰ ਰੋਜ਼ ਗਾਰਡਨ ਵਾਂ ਸੁਖਨਾ ਝੀਲ ਵਾ ਹੋਰ ਵੀ ਬਹੁਤ ਜਗ੍ਹਾ ਵਾ ਜਿੱਥੇ ਆਪਾਂ ਨੂੰ ਵਧੀਆ ਲੱਗਦਾ ਘੁੰਮ ਫਿਰ ਕੇ ਜਾਂ ਕਿਸੇ ਢਾਬੇ 'ਤੇ ਖਾਣਾ ਖਵਾਉਣ ਲੈ ਜਾਈਦਾ ਵਾ ਹੋਰ ਵੀ ਜਿੱਦਾਂ ਆਪਣੇ ਇੱਥੇ ਅੰਮ੍ਰਿਤਸਰ ਵਿੱਚ ਹੋਰ ਵੀ ਬੜੀਆਂ ਥਾਵਾਂ ਬਣਾਈਆਂ ਹੋਈਆਂ ਵਾਂ ਅਤੇ ਕੀ ਨਹਿਰਾਂ ਦੇ ਕੰਢਿਆਂ ਉੱਤੇ ਬਣਾਏ ਹੋਏ ਉਹਨਾਂ ਨੇ ਸੈਰ ਕਰਨ ਵਾਸਤੇ ਜਾਂ ਮਹਿਮਾਨਾਂ ਨੂੰ ਖੜ੍ਹਨ ਵਾਸਤੇ ਛੋਟੇ ਛੋਟੇ ਪਾਰਕ ਬਣਾਏ ਹੋਏ ਆਪਾਂ ਪਾਰਕ ਵੀ ਜਾ ਸਕਦੇ ਹਾਂ ਉੱਥੇ ਆਪਣੇ ਆਪਾਂ ਉੱਦਾਂ ਵੀ ਰੋਜ਼ਾਨਾ ਜ਼ਿੰਦਗੀ ਵਿੱਚ ਸੈਰ ਵੀ ਕਰ ਸਕਦੇ ਹਾਂ ਆਪਾਂ ਆਏ ਗਏ ਮਹਿਮਾਨ ਨੂੰ ਲੈ ਕੇ ਵੀ ਜਾ ਸਕਦੇ ਹਾਂ ਜਿਹੜਾ ਉਹਨਾਂ ਨੂੰ ਉੱਥੇ ਵਧੀਆ ਮਹਿਸੂਸ ਹੋਊਗਾ ਉਹਨਾਂ ਦੀ ਹਰ ਇੱਕ ਚੀਜ਼ ਜਿੱਦਾਂ ਹਰ ਇੱਕ ਆਪਾਂ ਨੂੰ ਖੁਸ਼ੀ ਮਿਲ ਜਾਂਦੀ ਉੱਥੇ ਜਾ ਕੇ ਮਨ ਖੁਸ਼ ਹੁੰਦਾ ਵਾ ਤੰਦਰੁਸਤੀ ਆਉਂਦੀ ਆ ਯਾਨੀ ਕਿ ਕੋਈ ਇੱਦਾਂ ਆਪਾਂ ਨੂੰ ਸਰੀਰ ਨੂੰ ਕੋਈ ਦੁੱਖ ਦਲਿੱਦਰ ਨਹੀਂ ਲੱਗਦਾ ਜਿਵੇਂ ਮਨ ਖੁਸ਼ ਰਹਿੰਦਾ ਸਾਰੀਆਂ ਘਰ ਦੀਆਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਆਪਾਂ